ਹੈਲੋ ਸਤਿ ਸ਼੍ਰੀ ਅਕਾਲ ਸਰ ਮੈਂ ਸੁਰਜੀਤ ਕੁਮਾਰ ਪਠਾਨਕੋਟ ਤੋਂ ਬੋਲਦਾ ਹਾਂ ਕਿ ਸਾਨੂੰ ਘੁੰਮਣ ਦਾ ਬੜਾ ਸ਼ੌਕ ਹੈ ਅਸੀਂ ਹਰ ਦੋ ਤਿੰਨ ਮਹੀਨਿਆਂ ਬਾਅਦ ਘੁੰਮਣ ਲਈ ਕੋਈ ਤਾਂ ਕੋਈ ਯਾਤਰਾ ਵਿੱਚ ਜਾਂਦੇ ਹਾਂ ਜਿੱਦਾਂ ਕਿ ਸਾਡੇ ਜੰਮੂ ਵਿੱਚ ਮਾਂ ਵੈਸ਼ਨੋ ਦੇਵੀ ਦਾ ਮੰਦਰ ਹੈ ਉੱਥੇ ਹਰ ਤਰ੍ਹਾਂ ਦੇ ਲੋਕ ਆਉਂਦੇ ਹਨ ਜ਼ਿਆਦਾਤਰ ਲੋਕ ਜੰਮੂ ਜੇ ਐਂਡ ਕੇ ਦੇ ਹੁੰਦੇ ਹਨ ਇਹ ਨਹੀਂ ਕਿ ਜੰਮੂ ਦੇ ਹੀ ਹਿਮਾਚਲ ਦੇ ਵੀ ਛੱਤੀਸਗੜ੍ਹੀ ਵੀ ਬਿਹਾਰ ਦੇ ਵੀ ਲੋਕ ਆਉਂਦੇ ਹਨ ਜੋ ਕਿ ਸਾਰਿਆਂ ਦੀਆਂ ਅਲੱਗ ਅਲੱਗ ਭਾਸ਼ਾਵਾਂ ਹੁੰਦੀਆਂ ਹਨ ਅਤੇ ਜ਼ਿਆਦਾਤਰ ਜਿੱਦਾਂ ਪੰਜਾਬ ਜੇ ਐਂਡ ਕੇ ਹਿਮਾਚਲ ਦੀ ਭਾਸ਼ਾ ਇੱਦਾਂ ਦੀ ਹੈ ਕਿ ਇਹ ਅਸੀਂ ਇਕ ਡੋਗਰੀ ਭਾਸ਼ਾ ਬੋਲਦੇ ਹਾਂ ਲੇਕਿਨ ਅਸੀਂ ਸਮਝ ਸਕਦੇ ਹਾਂ ਜ਼ਿਆਦਾ ਨਹੀਂ ਤਾਂ ਥੋੜ੍ਹੀ ਥੋੜ੍ਹੀ ਭਾਸ਼ਾ ਉਹਨਾਂ ਦੀ ਸਮਝ ਸਕਦੇ ਹਾਂ ਜੇਕਰ ਬਾਤ ਕਰੀਏ ਛੱਤੀਸਗੜ੍ਹੀ ਬਿਹਾਰ ਜਾਂ ਅਨਿਲਕ ਅਨੇ ਇਲਾਕਿਆਂ ਦੀ ਉਹ ਭਾਸ਼ਾ ਅਸੀਂ ਨਹੀਂ ਸਮਝ ਸਕਦੇ ਅਗਰ ਇਹਨਾਂ ਦੀ ਇਹਨਾਂ ਨਾਲ ਕੋਈ ਵੀ ਗੱਲਬਾਤ ਕਰਨੀ ਹੋਵੇ ਤਾਂ ਸਾਨੂੰ ਕਿਹੜੀ ਭਾਸ਼ਾ ਦਾ ਇਸਤੇਮਾਲ ਕਰਨਾ ਚਾਹੀਦਾ ਹੈ ਸਾਨੂੰ ਹੋ ਸਕੇ ਤਾਂ ਹਿੰਦੀ ਹਿੰਦੀ ਇਕ ਐਸੀ ਭਾਸ਼ਾ ਹੈ ਜੋ ਕਿ ਹਰ ਇੱਕ ਸਟੇਟ ਵਿੱਚ ਲੋਕ ਸਮਝ ਸਕਦੇ ਹਨ ਇਸ ਕਰਕੇ ਸਾਨੂੰ ਜ਼ਿਆਦਾ ਹਿੰਦੀ ਦੀ ਭਾਸ਼ਾ ਯੂਜ ਕਰਨੀ ਚਾਹੀਦੀ ਹੈ